ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਸਟੇਸ਼ਨ ਮਾਸਟਰ ਬੋਲ ਰਿਹਾ ਜੀ ਹਾਂ ਪੁੱਛੋ ਠੀਕ ਹੈ ਅਤੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਸਾਡਾ ਜਿਹੜਾ ਸੰਗਰੂਰ ਰੇਲਵੇ ਸਟੇਸ਼ਨ ਹੈਗਾ ਇੱਥੋਂ ਕਈ ਪਾਸੇ ਜਿਹੜੀਆਂ ਗੱਡੀਆਂ ਜਾਂਦੀਆਂ ਹੈਗੀਆਂ ਵੀ ਇੱਕ ਤਾਂ ਜਿਵੇਂ ਦਿੱਲੀ ਨੂੰ ਇੱਥੋਂ ਗੱਡੀ ਜਾਂਦੀ ਸਿੱਧੀ ਸਾਡੇ ਕੋਲੋਂ ਅਤੇ ਦਿੱਲੀ ਨੂੰ ਬਲਕਿ ਕਈ ਸਾਰੀਆਂ ਟਰੇਨਾਂ ਹੈਗੀਆਂ ਇੱਥੋਂ ਦਿਨ ਦੀਆਂ ਵੀ ਹੈਗੀਆਂ ਰਾਤ ਦੀਆਂ ਵੀ ਹੈਗੀਆਂ ਉੱਥੋਂ ਦਿੱਲੀ ਜਾ ਸਕਦੇ ਹੋ ਐਥੋਂ ਸਿੱਧੀ ਟਰੇਨ ਤੁਹਾਨੂੰ ਬਠਿੰਡੇ ਨੂੰ ਵੀ ਮਿਲ ਜੂਗੀ ਅਤੇ ਬਠਿੰਡੇ ਵਾਲੀ ਸਾਈਡ ਤੋਂ ਜਾਣਾ ਅਤੇ ਇੱਥੋਂ ਤੁਹਾਨੂੰ ਸਿੱਧੀ ਟਰੇਨ ਲੁਧਿਆਣੇ ਜਲੰਧਰ ਨੂੰ ਵੀ ਮਿਲ ਜੂਗੀ ਧੂਰੀ ਧੂਰੀ ਹੋ ਕੇ ਲੁਧਿਆਣੇ ਜਲੰਧਰ ਜਾਏਗੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਠਾਨਕੋਟ ਜੰਮੂ ਤੱਕ ਤੁਸੀਂ ਉੱਧਰ ਜਾ ਸਕਦੇ ਹੋ ਇੱਥੋ ਤੁਹਾਨੂੰ ਇੱਕ ਟਰੇਨ ਇੱਧਰ ਨੂੰ ਵੀ ਮਿਲ ਜੂਗੀ ਅੰਬਾਲੇ ਸਾਈ਼ਡ ਨੂੰ ਜਾਣ ਵਾਸਤੇ ਤੁਸੀ ਇੱਥੋਂ ਧੂਰੀਓ ਮੈਂ ਮੈਂ ਮੈਂ ਮੈਂ ਤੁਹਾਨੂੰ ਦੱਸ ਦਾਂਗਾ ਵੀ ਮੈਂ ਤੁਹਾਨੂੰ ਇਹ ਚਾਰ ਸਟੇਸ਼ਨ ਤਾਂ ਦੱਸੇ ਆ ਵੀ ਦੇਖੋ ਦਿੱਲੀ ਆ ਜਿਹੜਾ ਉਹ ਬਹੁਤ ਵੱਡਾ ਜੰਕਸ਼ਨ ਹੈ ਤੁਸੀਂ ਉੱਥੇ ਜਾਓਗੇ ਤੁਹਾਨੂੰ ਉਥੋਂ ਅੱਗੇ ਜਿੱਧਰ ਨੂੰ ਮਰਜ਼ੀ ਪੂਰੇ ਇੰਡੀਆ ਦੀ ਟ੍ਰੇਨ ਲੈ ਲਈਓ ਜੇ ਬਠਿੰਡੇ ਪਹੁੰਚੋਗੇ ਇੱਥੋਂ ਉਹ ਤਾਂ ਬਠਿੰਡਾ ਬਹੁਤ ਵੱਡਾ ਜੰਕਸ਼ਨ ਆ ਉਥੋਂ ਛੇ ਸੱਤ ਪਾਸੇ ਟ੍ਰੇਨਾਂ ਜਾਂਦੀਆਂ ਤੁਸੀਂ ਉੱਥੋਂ ਵੀ ਟ੍ਰੇਨ ਲੈ ਸਕਦੇ ਹੋ ਇੱਥੋਂ ਦੱਸ ਪੰਦਰਾਂ ਕਿਲੋਮੀਟਰ ਤੇ ਇੱਕ ਧੂਰੀ ਜੰਕਸ਼ਨ ਆਉਂਦਾ ਧੂਰੀ ਸਟੇਸ਼ਨ ਉੱਥੇ ਵੀ ਤਿੰਨ ਚਾਰ ਪਾਸੇ ਨੂੰ ਟ੍ਰੇਨਾਂ ਜਾਂਦੀਆਂ ਹੈਗੀਆਂ ਧੂਰੀ ਵਿੱਚ ਦੀ ਹੋ ਕੇ ਜੇ ਸਿੱਧਾ ਤੁਸੀਂ ਲੁਧਿਆਣੇ ਜਾਂ ਜਲੰਧਰ ਚਲੇ ਜਾਂਦੇ ਹੋ ਉੱਥੋਂ ਵੀ ਅਲੱਗ ਅਲੱਗ ਪਾਸੇ ਨੂੰ ਟਰੇਨਾਂ ਜਾਂਦੀਆਂ ਹੈਗੀਆਂ ਅਤੇ ਜੇ ਤੁਸੀਂ ਮੰਨ ਲਓ ਜਿਵੇ ਤੁਸੀ ਟੂਰਿਸਟ ਹੋ ਤਾਂ ਜਿਹੜੀਆਂ ਸਿੱਧੀਆ ਟ੍ਰੇਨਾਂ ਨੇ ਸਾਡੇ ਕੋਲ ਕਿ ਬਦਲਣੀ ਨਾ ਪਵੇ ਇੱਕ ਤਾਂ ਸਿੱਧੀ ਸਾਡੇ ਕੋਲ ਇੱਥੋ ਸਿੱਧੀ ਟਰੇਨ ਦੇਖੋ ਤੁਸੀ ਵੀ ਸਿੱਧੀ ਕੰਨਿਆਂ ਕੁਮਾਰੀ ਤੱਕ ਵੀ ਜਾਂਦੀ ਹੈ ਸਾਡੇ ਕੋਲ ਉਹ ਜੰਮੂ ਤੋਂ ਆਉਂਦੀ ਕੰਨਿਆ ਕੁਮਾਰੀ ਉਹ ਸਾਡੇ ਸੰਗਰੂਰ ਵਿੱਚੋਂ ਲੰਘਦੀ ਹੈ ਵੀ ਉਦੇ ਤੁਸੀਂ ਨਹੀਂ ਮੈਟਰੋ ਸਟੇਸ਼ਨ ਦੇਖੋ ਮੈਟਰੋ ਵੱਡੇ ਵੱਡੇ ਸ਼ਹਿਰਾਂ 'ਚ ਹੈਗੀ ਹੈ ਪਰ ਇੱਥੇ ਪੰਜਾਬ ਦੇ ਵਿੱਚ ਸਾਡੇ ਸੰਗਰੂਰ 'ਚ ਤਾਂ ਖਾਸ ਕਰਕੇ ਮੈਟਰੋ ਨਹੀਂ ਹੈਗੀ ਕਿਉਂਕਿ ਇੰਨੀ ਜ਼ਿਆਦਾ ਆਬਾਦੀ ਨਹੀਂ ਹੈਗੀ ਮੈਟਰੋ ਨਹੀਂ ਚੱਲਣੀ ਜਿਵੇਂ ਤੁਸੀਂ ਟੂਰਿਸਟ ਤੋਂ ਦੂਰ ਦੇਣ ਜਾਣਾ ਤੁਹਾਨੂੰ ਟ੍ਰੇਨਾਂ ਮਿਲ ਜਾਣਗੀਆਂ ਸਾਰੇ ਤਰ੍ਹਾਂ ਦੀਆਂ ਇੱਥੋਂ ਹਾਂ ਅੱਗੇ ਹਾਂ ਅੱਗੇ ਅੱਗੇ ਤੁਹਾਨੂੰ ਹਾਂ ਟੈਕਸੀ ਲੈਣੀ ਪੈ ਸਕਦੀ ਹੈ ਦੇਖੋ ਦਿੱਲੀ ਵੱਲ ਸਾਡੇ ਕੋਲ ਦੋ ਤਿੰਨ ਤਰ੍ਹਾਂ ਦੀਆਂ ਟਰੇਨਾਂ ਹੈ ਇੱਕ ਤਾਂ ਪੈਸੰਜਰ ਟਰੇਨਾਂ ਜਿਹੜੀ ਹਰ ਸਟੇਸ਼ਨ 'ਤੇ ਰੁਕੁਗੀ ਪਰ ਟਾਈਮ ਵੱਧ ਲਾਉਣਗੀਆਂ ਪਰ ਕਿਰਾਇਆ ਬੜਾ ਹੀ ਘੱਟ ਹੈ ਦਿੱਲੀ ਦੇ ਸਾਰੇ ਪੰਜਾਹ ਰੁਪਏ ਲੱਗਣੇ ਤੁਹਾਡੇ ਅਤੇ ਦੂਜੀ ਹੈਗੀ ਸਾਡੇ ਕੋਲ ਮੇਲ ਟਰੇਨਾਂ ਐਕਸਪ੍ਰੈਸ ਮੇਲ ਟਰੇਨਾਂ ਉਹਨਾਂ ਦਾ ਜਿਹੜਾ ਕਿਰਾਇਆ ਜੇ ਤੁਸੀਂ ਬੈਠ ਕੇ ਜਾਣਾ ਹੈਗਾ ਤੁਹਾਡਾ ਇੱਕ ਸੌ ਪੰਜ ਰੁਪਏ ਲੱਗੇਗਾ ਉਸ ਤੋਂ ਬਾਅਦ ਸਾਡੇ ਕੋਲ ਹੈਗੀਆਂ ਸੁਪਰਫਾਸਟ ਐਕਸਪ੍ਰੈਸ ਟਰੇਨਾਂ ਜਿਹੜੀਆਂ ਕੀ ਟਾਈਮ ਘੱਟ ਲਗਾਉਣਗੀਆਂ ਜ਼ਿਆਦਾ ਤੇਜ਼ ਚੱਲਣਗੀਆਂ ਉਹਨਾਂ ਦਾ ਕਿਰਾਇਆ ਤੁਹਾਨੂੰ ਪੈਣਾ ਹੀ ਆ ਵੀਹ ਰੁਪਏ ਹੋਰ ਇੱਕ ਸੌ ਪੱਚੀ ਰੁਪਏ ਇਹ ਸਾਰਾ ਬੈਠਣ ਵਾਲਾ ਕਿਰਾਇਆ ਜੇ ਤੁਸੀਂ ਲੇਟ ਕੇ ਜਾਣਾ ਸਲੀਪਰ ਕਲਾਸ ਦੇ ਵਿੱਚ ਜਾਣਾ ਸੌਂ ਕੇ ਜਾਣਾ ਤਾਂ ਉਹਦੀ ਤੁਹਾਨੂੰ ਐਡਵਾਂਸ ਰਿਜਰਵੇਸ਼ਨ ਜਾਂ ਬੁਕਿੰਗ ਕਰਾਉਣੀ ਪਵੇਗੀ ਉਹਦੇ ਫਿਰ ਡੇਢ ਸੌ ਰੁਪਏ ਹੋਰ ਲੱਗਦਾ ਤਾਂ ਚਲੋ ਵੀ ਤੁਹਾਨੂੰ ਦੋ ਇੱਕ ਸੌ ਵੀਹ ਉਹ ਤਾਂ ਡੇਢ ਸੌ ਉਹ ਦੋ ਸੌ ਸੱਤਰ ਦੇ ਆਸਪਾਸ ਦਿੱਲੀ ਦਾ ਕਿਰਾਇਆ ਪਏਗਾ

ਨਹੀਂ ਐਂ ਨਹੀਂ ਹੋ ਸਕਦੀ ਜੀ ਉਹ ਤੁਹਾਨੂੰ ਸਟੇਸ਼ਨ 'ਤੇ ਆਉਣਾ ਪੈਣਾ ਬੁਕਿੰਗ ਦਾ ਹੋਇਆ ਟਾਈਮ ਸਵੇਰੇ ਅੱਠ ਤੋਂ ਪੰਜ ਵਜੇ ਤੱਕ ਉੱਥੇ ਆ ਕੇ ਤੁਸੀਂ ਆਪਣੀ ਐਪਲੀਕੇਸ਼ਨ ਦੇ ਜੋ ਤੁਹਾਡੀ ਜਿਹੜੀ ਟਿਕਟ ਏ ਬੁੱਕ ਹੋ ਜੂਗੀ ਜਿੰਨੀ ਤਾਰੀਖ ਦੀ ਸੀਟ ਵੈਕੰਟ ਹੋਵੇਗੀ ਉਹ ਬੁੱਕ ਹੋ ਜੂਗੀ ਅਤੇ ਉਹਦੇ ਵਿੱਚ ਫਿਰ ਤੁਸੀ ਉਸ ਤਾਰੀਖ ਨੂੰ ਸਫਰ ਕਰ ਸਕਦੇ ਹੋ ਜਿਹੜੀਆਂ ਪੈਸੰਜਰ ਗੱਡੀਆਂ ਨੇ ਉਹਦੇ ਵਿੱਚ ਤੁਸੀ ਟਿਕਟ ਲੈ ਕੇ ਬੈਠ ਸਕਦੇ ਹੋ ਹਾਂ ਉਹ ਤੁਸੀਂ ਆਪਣਾ ਥੋੜ੍ਹਾ ਜਿਹਾ ਦੇਖ ਲੈਣਾ ਐਪ ਹੈਗੀ ਆ ਆਈਆਰਸੀਟੀਸੀ ਕਰਕੇ ਉਹ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਉਥੋਂ ਵੀ ਬੁੱਕ ਕਰ ਸਕਦੇ ਹੋ ਸਟੇਸ਼ਨ ਪਾ ਕੇ ਜੇ ਕੋਈ ਦਿੱਕਤ ਹੋਈ ਤੁਸੀਂ ਮੈਨੂੰ ਫੋਨ ਕਰ ਲੈਣਾ ਨਾ ਨਾ ਨਾ ਰਾਤ ਨੂੰ ਵੀ ਚੌਵੀ ਘੰਟੇ ਇੱਥੇ ਕੋਈ ਨਾ ਕੋਈ ਹੁੰਦਾ ਜੀ ਜਦੋਂ ਮਰਜ਼ੀ ਫੋਨ ਕਰ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਠੀਕ ਆ ਜੀ ਓਕੇ ਜੀ ਥੈਂਕ ਯੂ